ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਐਕਚੁਲੀ ਮੇਰੀ ਖੁਦ ਦੀ ਵੈਡਿੰਗ ਹੈ ਤੁਸੀਂ ਗੀਤ ਵੈਡਿੰਗ ਤੋਂ ਗੱਲ ਕਰ ਰਹੇ ਹੋ ਨਾ ਹਾਂਜੀ ਮੈਂ ਤੁਹਾਡੇ ਨਾ ਐਕਚੁਲੀ ਵੈਡਿੰਗ ਪਲੈਨਰ ਦੀ ਪੈਕਜ ਬਾਰੇ ਗੱਲ ਕਰਨੀ ਸੀ ਕਿ ਕਿਵੇਂ ਕਿਵੇਂ ਦੇ ਪੈਕਜਿਸ ਹੈਗੇ ਹੈ ਤੁਹਾਡੇ ਕੋਲ ਥੋੜ੍ਹਾ ਜਿਹਾ ਮੈਨੂੰ ਐਕਸਪਲੇਨ ਕਰੋਂਗੇ

ਤੁਹਾਡਾ ਮਿਨੀਮਮ ਕਿੰਨੇ ਤੋਂ ਸਟਾਰਟ ਹੈ ਤੁਹਾਡਾ ਪੈਕਿਜ ਮਿਂ ਮੈਂ ਕਿਹਾ ਮਿਨੀਮਮ ਪੈਕਿਜ ਕਿੰਨੇ ਤੋਂ ਸਟਾਰਟ ਹੈ ਤੁਹਾਡਾ ਠੀਕ ਹੈ ਫਿਫਟੀ ਥਾਊਸੈਂਡ ਤੋਂ ਸਟਾਰਟ ਹੈ ਤੁਹਾਡਾ ਸਿਰਫ ਸਿਰਫ ਡੈਕੋਰੇਸ਼ਨ ਦਾ ਹੈ ਨਾ ਅਤੇ ਜੇ ਵਿੱਚ ਆਪਾਂ ਮਿਨੀਊਸ ਵੀ ਐਡ ਕਰੀਏ ਖਾਣੇ ਦਾ ਅਤੇ ਫਿਰ ਉਹਦਾ ਕੀ ਹੋਏਗਾ ਠੀਕ ਹੈ ਤੁਸੀਂ ਮੈਨੂੰ ਦੋ ਲੱਖ ਵਾਲੇ ਪੈਕਜ ਦੇ ਵਿੱਚ ਹੀ ਦੱਸ ਦਿਉ ਕਿ ਇੱਕ ਤਾਂ ਮੈਨੂੰ ਇਹ ਦੱਸ ਦਿਉ ਇਹ ਤੁਹਾਡਾ ਇੱਕ ਦਿਨ ਦਾ ਹੋਏਗਾ ਜੋ ਵੀ ਪੈਕਜ ਹੋਏਗਾ ਜਾਂ ਦੋ ਦਿਨ ਦਾ ਜਿਵੇਂ ਲੇਡੀ ਸੰਗੀਤ ਹੋਏਗਾ ਅਤੇ ਉੱਧਰ ਨੈਕਸਟ ਡੇ ਮੇਨ ਡੇ ਤਾਂ ਹੁੰਦਾ ਹੀ ਹੈ ਨਾ ਠੀਕ ਹੈ ਅਤੇ ਉਸ ਦਿਨ ਦਾ ਮਤਲਬ ਖਾਣੇ ਦਾ ਨਹੀਂ ਹੋਏਗਾ ਇਕ ਦਿਨ ਪਹਿਲੇ ਦਾ ਠੀਕ ਹੈ

ਨਹੀਂ ਮੈਂ ਪੈਕਿਜ ਦੇ ਵਿੱਚ ਹੀ ਗਿਣ ਲਿਆ ਠੀਕ ਹੈ ਅਤੇ ਜਿਵੇਂ ਤੁਹਾਡੀ ਡੈਕੋਰੇਸ਼ਨ ਹੈ ਜਿਹੜੀ ਤੁਸੀਂ ਇਨਡੋਰ ਆਊਟਡੋਰ ਜੋ ਵੀ ਕਰਨੀ ਹੋਏਗੀ ਉਹਦੇ ਵਿੱਚ ਸਾਰੀ ਫਲਾ ਫਲਾਰ ਡੈਕੋਰੇਸ਼ਨ ਕਰ ਦਿਉ ਜਾਂ ਅੰਦਰ ਜਿਵੇਂ ਚੁੰਨੀਆਂ ਵਗੈਰਾ ਦੀ ਕਰ ਦਿੰਦੇ ਹੈ ਬਾਹਰ ਫੁੱਲਾਂ ਦੀ ਕਰ ਦਿੰਦੇ ਹੋ ਐਵੇਂ ਕਰ ਦਿਉ

ਠੀਕ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਮੈਂ ਨਾ ਤੁਹਾਨੂੰ ਇੱਕ ਵਾਰੀ ਕਨਫਰਮ ਕਰਵਾ ਦੇਵਾਂਗੀ ਜਿਹੜਾ ਇੱਕ ਵਾਰ ਮਿਲ ਕੇ ਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਓਕੇ